ਸਾਡੇ ਇਲਾਕੇ ਵਿੱਚ ਅਪਰਾਧ ਦੀ ਬਹੁਤ ਜ਼ਿਆਦਾ ਕਾਰਨ ਹਨ ਪਰ ਇਹਨਾਂ ਵਿੱਚੋਂ ਗਰੀਬੀ ਇੱਕ ਅਜਿਹਾ ਕਾਰਨ ਹੈ ਜਿਸ ਨੂੰ ਅਸੀਂ ਨਿਗਲੈਕਟ ਨਹੀਂ ਕਰ ਸਕਦੇ ਗਰੀਬੀ ਚੰਗੇ ਭਲੇ ਆਦਮੀ ਨੂੰ ਅਪਰਾਧ ਕਰਨ 'ਤੇ ਮਜ਼ਬੂਰ ਕਰ ਦਿੰਦੀ ਹੈ ਇੱਥੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਅਤੇ ਉਸ ਦੇ ਕਾਰਨ ਹੀ ਜਦੋਂ ਬੰਦਾ ਘਰ ਭੁੱਖਾ ਮਰ ਰਿਹਾ ਹੈ ਤਾਂ ਉਹ ਬਾਹਰ ਜਾ ਕੇ ਚੋਰੀ ਕਰਦਾ ਹੈ ਚੋਰੀ ਕਰਦਾ ਹੈ ਜਾਂ ਕੋਈ ਕਿਸੇ ਦੇ ਘਰ ਜਾ ਕੇ ਉਹ ਕਿਸੇ ਨੂੰ ਹਰਟ ਕਰਕੇ ਮਤਲਬ ਸਮਾਨ ਚੋਰੀ ਕਰਦਾ ਹੈ ਤਾਂ ਇਹ ਹੀ ਕਾਰਨ ਹੈ ਕਿ ਉਹ ਇੱਕ ਅਪਰਾਧੀ ਕਹਿਲਾਇਆ ਜਾਂਦਾ ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਹੈ ਗਰੀਬੀ ਅਤੇ ਬੇਰੁਜ਼ਗਾਰੀ ਦੋਨਾਂ ਨੂੰ ਸੁਧਾਰਨ ਲਈ ਸਰਕਾਰ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਉਹਨਾਂ ਨੂੰ ਬੇਰੁਜ਼ਗਾਰਾਂ ਨੂੰ ਅ ਰੁਜ਼ਗਾਰ ਦੇਣ ਦੀ ਲੋੜ ਹੈ ਗਰੀਬੀ ਨੂੰ ਘਟਾਉਣ ਲਈ ਕੁਝ ਨੀਤੀਆਂ ਕੋਈ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ ਇਹਨਾਂ ਨੂੰ ਸੁਧਾਰਨ ਲਈ ਸਰਕਾਰੀ ਨੇਤਾਵਾਂ ਅਤੇ ਪ੍ਰਸ਼ੰਸਕਾਂ ਨੂੰ ਵੀ ਜ਼ਰੂਰੀ ਬਹੁਤ ਸਖ਼ਤੀ ਵਾਲੇ ਕਦਮ ਉਠਾਉਣੇ ਚਾਹੀਦੇ ਹਨ